ਮੇਰਾ ਸਭ ਤੋਂ ਅਨੁਭਵੀ ਬਾਈਕਿੰਗ ਐਕਸਪੀਰੀਅੰਸ ਹੈਗਾ ਆ ਆਪਣੇ ਦੋਸਤਾਂ ਨਾਲ ਮਨਾਲੀ ਅਤੇ ਲੱਦਾਖ ਜਾਣਾ ਜਿਸ ਕਰਕੇ ਅਸੀਂ ਗਰਮੀ ਛੁੱਟੀਆਂ ਵਿੱਚ ਇਹ ਪੁਸ਼ਟੀ ਕੀਤੀ ਕਿ ਸਾਡੇ ਕੋਲ ਦਸ ਤੋਂ ਬਾਰ੍ਹਾਂ ਦਿਨ ਲੱਦਾਖ ਘੁੰਮਣ ਲਈ ਅਤੇ ਪੰਜ ਤੋਂ ਛੇ ਦਿਨ ਮਨਾਲੀ ਘੁੰਮਣ ਲਈ ਹੋਣੇ ਚਾਹੀਦੇ ਆ ਜਦੋਂ ਸਾਨੂੰ ਗਰਮੀਆਂ ਦੇ ਛੁੱਟੀਆਂ ਪਈਆਂ ਤਾਂ ਅਸੀਂ ਆਪਣੇ ਸਾਰੇ ਘਰਦਿਆਂ ਤੋਂ ਥੋੜ੍ਹੇ ਥੋੜ੍ਹੇ ਪੈਸੇ ਲੈ ਕੇ ਆਪਣੀ ਬਾਈਕਾਂ ਤਿਆਰ ਕਰ ਲਈਆਂ ਕਿਸੇ ਨੇ ਪੈਟਰੋਲ ਭਰਵਾ ਲਿਆ ਕਿਸੇ ਨੇ ਨਵਾਂ ਫੋਨ ਲੈ ਲਿਆ ਤਾਂ ਜੋ ਉਹ ਨਵੀਂ ਫੋਟੋਆਂ ਖਿੱਚ ਸਕਣ ਅਸੀਂ ਕਿਹੜੇ ਹੋਟਲ ਜਾਣਾ ਸੀ ਕਿੱਥੇ ਕਿੱਥੇ ਰਹਿਣਾ ਸੀ ਕਿਹੜੀ ਨਦੀ ਦੇਖਣੀ ਸੀ ਅਸੀਂ ਸਾਰਾ ਦੇਖ ਲਿਆ ਇਸ ਜਦੋਂ ਸਾਨੂੰ ਪਤਾ ਲੱਗਾ ਕਿ ਸਾਨੂੰ ਰਾਤ ਨੂੰ ਨਿਕਲਣਾ ਹੈ ਤਾਂ ਸਾਡੇ ਘਰ ਦੇ ਪਹਿਲੇ ਤਾਂ ਮਨ੍ਹਾ ਕਰਨ ਪਰ ਅਸੀਂ ਅਗਲੇ ਦਿਨ ਸਵੇਰੇ ਪੰਜ ਵਜੇ ਨਿਕਲੇ ਰਾਹ ਜਾਂਦੇ ਹੀ ਮੇਰਾ ਬਾਈਕ ਦਾ ਟਾਇਰ ਪੈਂਚਰ ਹੋ ਗਿਆ ਤਾਂ ਜੋ ਮੈਂ ਆਪਣੇ ਦੋਸਤਾਂ ਤੋਂ ਬਹੁਤਾ ਦੂਰ ਹੋ ਗਿਆ ਜਦੋਂ ਮੈਨੂੰ ਉਹਨਾਂ ਦਾ ਫੋਨ ਆਇਆ ਤਾਂ ਉਹ ਕਹਿੰਦੇ ਕਿ ਤੂੰ ਕਾਫੀ ਦੂਰ ਹੈ ਇਸ ਕਰਕੇ ਛੇਤੀ ਬਾਈਕ ਭਜਾ ਅਤੇ ਛੇਤੀ ਆ ਮੈਂ ਉਸ ਹੀ ਹੱਲਾਸ਼ੇਰੀ 'ਚ ਛੇਤੀ ਛੇਤੀ ਬਾਈਕ ਭਜਾਈ ਅਤੇ ਪਹਾੜਾਂ ਦਾ ਲੁਤਫ਼ ਲਿੱਤਾ